ਸਾਡੇ ਪ੍ਰੋਗਰਾਮ ਸੱਭਿਆਚਾਰ ਬਹੁਤ ਹੀ ਵਧੀਆ ਨੇ ਜੀ ਦੇਖੋ ਜੋ ਜਿਹਦੇ ਅੰਦਰ ਵਿਸਾਖੀ ਦਿਵਾਲੀ ਹੋਲੀ ਲੋਹੜੀ ਬਹੁਤ ਹੀ ਤਿਉਹਾਰ ਆਉਂਦੇ ਨੇ ਜਿਸ ਦੇ ਵਿੱਚ ਦਿਵਾਲੀ ਨੂੰ ਅਸੀਂ ਮਠਿਆਈ ਵੀ ਖਾਂਦੇ ਹਾਂ ਅਤੇ ਨਾਲੇ ਪੂਜਾ ਵੀ ਲੱਛਮੀ ਮਾਂ ਦੀ ਕਰਦੇ ਹਾਂ ਉਹ ਪਟਾਕੇ ਵੀ ਚਲਾਈਦੇ ਹੈ ਬਹੁਤ ਇੰਜੋਏ ਕਰੀਦਾ ਜੀ ਜਿਸ ਤਰ੍ਹਾਂ ਵਿਸਾਖੀ ਨੂੰ ਸਾਡੇ ਵਿਸਾਖੀ ਦੀ ਮੇਲ ਲੱਗਦੀ ਹੈ ਜੀ ਹੋਰ ਵੀ ਵਿਸਾਖੀ ਮਨਾਉਂਦੀ ਜਿਹਦੇ ਨਾਲ ਲੋਕ ਜਲੇਬੀਆਂ ਬਹੁਤ ਖਾਂਦੇ ਆ ਪਕੋੜੇ ਖਾ ਬਹੁਤ ਕੁ ਖਾਂਦੇ ਆ ਮਜ਼ੇਦਾਰ ਖਾਣ ਨੂੰ ਮਿਲਦੇ ਹੈ ਜਦੋਂ ਹੋਲੀ ਨੂੰ ਹੋਲੀ ਇੱਕ ਪਿਆਰ ਦਾ ਤਿਉਹਾਰ ਹੈ ਜਿਹਦੇ ਵਿੱਚ ਰੰਗ ਬਿਰੰਗੇ ਰੰਗਾਂ ਨਾਲ ਮਨਾਈ ਜਾਂਦੀ ਹੈ ਜੀ ਇਹ ਇੱਕ ਪਿਆਰ ਦਾ ਤਿਉਹਾਰ ਹੈ ਅਸੀਂ ਆਪਣੇ ਯਾਰਾਂ ਬੇਲੀਆਂ ਨੂੰ ਬੜਾ ਰੰਗ ਲਗਾਇਆ ਜਾਂਦਾ ਹੈ ਜੀ ਲੋਹੜੀ ਵੀ ਵਾਲ ਕੇ ਲੋਕ ਬਹੁਤ ਹੀ ਇੰਜੋਏ ਕਰਦੇ ਜੀ ਸਵੇਰੇ ਪਤੰਗਾਂ ਉਡਾਉਂਦੇ ਨੇ ਲੇਕਿਨ ਸਾਡੇ ਜਿੰਨੇ ਵੀ ਤਿਉਹਾਰ ਹੈ ਸਮੇਂ ਦੇ ਨਾਲ ਬਦਲਦੇ ਜਾ ਰਹੇ ਨੇ ਲੇਕਿਨ ਹੁਣ ਵੀ ਅੱਜ ਵੀ ਸਾਡੇ ਤਿਉਹਾਰ ਬਹੁਤ ਚੰਗੇ ਨੇ ਬਹੁਤ ਹੀ ਪਿਆਰ ਮੁਹੱਬਤ ਨਾਲ ਮਨਾਏ ਜਾਂਦੇ ਨੇ ਜਿਹਦੇ ਨਾਲ ਵੀ ਲੋਕਾਂ ਦੇ ਵਿੱਚ ਵੀ ਪਿਆਰ ਵੀ ਦੇਖਣ ਨੂੰ ਮਿਲਦਾ ਹੈ ਮਿਲ ਜੁਲ ਕੇ ਹੀ ਸਭ ਤਿਉਹਾਰ ਮਨਾਉਣ ਦਾ ਮਜ਼ਾ ਵੀ ਆਉਂਦਾ ਜੀ ਔਰ ਖਾਣ ਪੀਣ ਦਾ ਵੀ ਮਜ਼ਾ ਵੀ ਬਹੁਤ ਆਉਂਦਾ ਹੈ ਜੀ ਇੰਜੋਏ ਵੀ ਬੱਚੇ ਬੜਾ ਕਰਦੇ ਹੈ ਇਸ ਲਈ ਬਹੁਤ ਹੀ ਸਹੀ ਢੰਗ ਨਾਲ ਤਿਉਹਾਰ ਸਾਨੂੰ ਮਨਾਉਣੇ ਚਾਹੀਦੇ ਸੱਭਿਆਚਾਰ ਪ੍ਰੋਗ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਲੇਕਿਨ ਅੱਜ ਲੋਕ ਕੁਛ ਕਾਫ਼ੀ ਬਦਲਾਅ ਦੇਖਣ ਨੂੰ ਮਿਲਿਆ ਲੋਕਾਂ 'ਚ ਇੰਨਾ ਪਿਆਰ ਮੁਹੱਬਤ ਨਹੀਂ ਵੀ ਹੈ ਲੇਕਿਨ ਫਿਰ ਵੀ ਕਾਫ਼ੀ ਹੱਦ ਤੱਕ ਇਹ ਤਿਉਹਾਰ ਬਹੁਤ ਹੀ ਪਿਆਰ ਮੁਹੱਬਤ ਨਾਲ ਮਨਾਈ ਜਾਂਦੇ ਨੇ